ਹੈਲੋ ਨਮਸਤੇ ਯੈੱਸ ਮੈਮ ਮੇਰਾ ਨਾਮ ਪ੍ਰਿਯੰਕਾ ਹੈ ਹਾਂਜੀ ਮੈਮ ਮੈਂ ਕਪੂਰਥਲਾ ਗਾਰਡਨ ਤੋਂ ਬੋਲਦੀ ਹਾਂ ਅਸੀਂ ਇਹੀ ਕੰਮ ਕਰਦੇ ਹਾਂ ਕਿ ਅਸੀਂ ਘਰਾਂ ਵਿੱਚ ਜਾ ਕੇ ਬੂਟੇ ਲਗਾਉਂਦੇ ਹਾਂ ਤੁਸੀਂ ਕਿਵੇਂ ਦੇ ਬੂਟੇ ਪਸੰਦ ਕਰਦੇ ਹੋ ਦੱਸ ਸਕਦੇ ਹੋ ਫੁੱਲਾਂ ਵਾਲੇ ਜਾਂ ਜੋ ਘਰ ਦੇ ਵਿੱਚ ਸਿਰਫ ਹਰੇ ਹਰਿਆਲੀ ਲੈ ਕੇ ਆਉਣ ਓਕੇ ਮੈਮ ਹਾਂਜੀ ਮੈਮ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ ਕਿ ਜਿਹਦੇ ਵਿੱਚ ਅਸੀਂ ਤੁਹਾਨੂੰ ਫੁੱਲਾਂ ਵਾਲੇ ਬੂਟੇ ਲਗਾ ਸਕਦੇ ਹਾਂ ਅਤੇ ਅਸੀਂ ਤੁਹਾਨੂੰ ਹਰਿਆਲੀ ਵਾਲੇ ਬੂਟੇ ਵੀ ਲਗਾ ਸਕਦੇ ਹਾਂ ਇਸਦੇ ਨਾਲ ਨਾਲ ਅਸੀਂ ਇੱਥੋਂ ਦੇ ਘਰ ਵਿੱਚ ਦਰਖਤ ਵੀ ਲਗਾ ਸਕਦੇ ਹਾਂ ਜਿਵੇਂ ਕਿ ਬਰਗਦ ਦਾ ਪੇੜ ਹੋ ਗਿਆ ਜਾਂ ਅਸ਼ੋਕਾ ਇੱਕ ਹੁੰਦਾ ਪੇੜ ਉਹ ਵੀ ਲਗਾ ਸਕਦੇ ਹਾਂ ਅਤੇ ਥੋੜ੍ਹੀ ਜਿਹੀ ਹਰਿਆਲੀ ਦੇ ਲਈ ਇੱਕ ਫਾਈਕਲ ਮੈਡਮ ਇਸ ਜਿਸ ਤਰੀਕੇ ਦਾ ਤੁਹਾਡਾ ਏਰੀਆ ਹੋਊਗਾ ਜਿਸ ਤਰੀਕੇ ਤੁਹਾਡੀ ਘਰ ਦੀ ਜਗ੍ਹਾ ਹੋਏਗੀ ਉਸ ਦੇ ਅਕੋਰਡਿੰਗ ਹੀ ਬੂਟਿਆਂ ਦਾ ਖਰਚਾ ਆਉਂਦਾ ਹੁੰਦਾ ਜਿਵੇਂ ਕਿ ਤੁਸੀਂ ਸੌ ਬੂਟਾ ਲਗਾਉਣਾ ਹੈ ਆਪਣੇ ਘਰ ਦੇ ਵਿੱਚ ਤਾਂ ਉਸਦੀ ਕੋਸਟ ਦਸ ਹਜ਼ਾਰ ਤੱਕ ਦੀ ਆਏਗੀ ਉਸਦੇ ਵਿੱਚ ਖਰਚਾ ਦਸ ਹਜ਼ਾਰ ਤੱਕ ਆਏਗਾ ਉਸਦੇ ਵਿੱਚ ਤੁਹਾਡੇ ਗਮਲੇ ਤੁਹਾਡੇ ਬੂਟੇ ਤੁਹਾਡੀ ਖਾਦ ਤੁਹਾਡੀ ਵਰਮਿੰਗ ਕੰਪੋਸਟਿੰਗ ਮਿੱਟੀ ਸਭ ਕੁਝ ਇਸ ਸਾਡੀ ਜਿਹੜੀ ਇੱਕ ਕੰਪਨੀ ਹੈ ਕਪੂਰਥਲਾ ਫਲਾਰੀ ਉਹਨਾਂ ਦੇ ਵੱਲੋਂ ਹੀ ਪੇਸ਼ ਕੀਤਾ ਜਾਵੇਗਾ

ਮੈਡਮ ਇਹ ਦਸ ਦਿਨ ਦਾ ਦਸ ਦਿਨ ਦਾ ਕੰਮ ਹੁੰਦਾ ਅਸੀਂ ਦਸ ਦਿਨ ਦੇ ਵਿੱਚ ਸੌ ਬੂਟਾ ਕਿਸੀ ਵੀ ਘਰ ਦੇ ਵਿੱਚ ਲਗਾ ਸਕਦੇ ਹਾਂ ਜੇ ਤੁਹਾਨੂੰ ਘਾਹ ਵੀ ਚਾਹੀਦੀ ਹੈ ਤਾਂ ਅਸੀਂ ਫਰੈਂਚ ਘਾਹ ਵੀ ਦਿੰਦੇ ਹਾਂ ਉਹਦੇ ਵੀ ਸਾਡੀ ਇੱਕ ਹੈ ਸੇਵਾ ਅਤੇ ਅਸੀਂ ਉਹਦੇ ਨਾਲ ਵੀ ਫਰੈਂਚ ਘਾਹ ਵੀ ਤੁਹਾਡੇ ਏਰੀਆ ਵਿੱਚ ਲਗਾ ਸਕਦੇ ਹਾਂ ਘਰ ਦੇ ਵਿੱਚ ਮੈਮ ਜੇ ਤੁਸੀਂ ਘਾਹ ਵੀ ਵਿੱਚ ਲਗਾਉਣਾ ਚਾਹੁੰਦੇ ਹੋ ਅਤੇ ਪੇੜ ਵੀ ਲਗਾਉਣਾ ਚਾਹੁੰਦੇ ਹੋ ਅਤੇ ਬੂਟੇ ਵੀ ਹੋਣ ਤੁਹਾਡੇ ਕੋਲ ਸੌ ਕੁ ਤਾਂ ਸਾਡੇ ਸਾਡੇ ਗਾਰਡਨ ਵੱਲੋਂ ਉਸਦੀ ਕੋਸਟ ਵੀਹ ਹਜ਼ਾਰ ਤੱਕ ਦਾ ਬਜਟ ਤੁਹਾਨੂੰ ਲਗਾਉਣਾ ਚਾਹੀਦਾ ਆਪਣੇ ਕੋਲ ਅਤੇ ਇਸ ਦੇ ਅੰਦਰ ਸਾਡੀ ਸਰਵਿਸ ਜਿਹੜੀ ਸਾਡੀ ਕੰਪ ਕੰਪਨੀ ਦੇ ਮਾਲੀ ਆਉਣਗੇ ਤੁਹਾਡੇ ਕੋਲ ਉਹ ਵੀ ਤੁਹਾਨੂੰ ਇਸ ਦੇ ਵਿੱਚ ਸਭ ਕੁਛ ਦੇਣਗੇ ਨਹੀਂ ਮੈਮ ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਸਾਨੂੰ ਗਮਲੇ ਦੱਸ ਸਕਦੇ ਹੋ ਕਿ ਤੁਹਾਨੂੰ ਕਿਵੇਂ ਦੇ ਗਮਲੇ ਚਾਹੀਦੇ ਹੈ ਬਹੁਤ ਤਰੀਕੇ ਦੇ ਗਮਲੇ ਆਉਂਦੇ ਹੈ ਸਟੈਂਡ ਵੀ ਹੁੰਦੇ ਨੇ ਮੈਡਮ ਜਿਨ੍ਹਾਂ ਦੇ ਉੱਤੇ ਆਪਾਂ ਗਮਲਿਆਂ ਨੂੰ ਰੱਖ ਸਕਦੇ ਹਾਂ ਗਮਲੇ ਵੀ ਮਿੱਟੀ ਦੇ ਹੋ ਸਕਦੇ ਨੇ ਜੀ ਸੈਰਾਮਿਕ ਹੋ ਸਕਦੇ ਹੈ ਪਲਾਸਟਿਕ ਲਗਾਉਣੇ ਚਾਹੁੰਦੇ ਹੋ ਕੁਛ ਬੂਟੇ ਟੰਗਣਾ ਮੈਡਮ ਮੈਂ ਤਾਂ ਤੁਹਾਨੂੰ ਕਹਾਂਗੀ ਕਿ ਤੁਸੀਂ ਪਲਾਸਟਿਕ ਵੀ ਲੈ ਸਕਦੇ ਹੋ ਸੈਰਾਮਿਕ ਵੀ ਅਤੇ ਮਿੱਟੀ ਵਾਲੇ ਵੀ ਅਤੇ ਜ਼ਿਆਦਾ ਫਾਇਦੇ ਮਿੱਟੀ ਵਾਲੇ ਦੇ ਹੁੰਦਾ ਕਿਉਂਕਿ ਉਹਨਾਂ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਤਰੀਕੇ ਦੇ ਨਾਲ ਹਵਾ ਵੜ ਸਕਦੀ ਹੈ ਉਸਦੇ ਅੰਦਰ ਤਾਂ ਸਾਰਾ ਬੈਟਰ ਓਕੇ ਮੈਮ ਥੈਂਕ ਯੂ